ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਕੀ ਹਾਲ ਚਾਲ ਹੈ ਬਸ ਵਧੀਆ ਵਧੀਆ ਹਾਂਜੀ ਹਾਂਜੀ ਅਤੇ ਸਰ ਅਸੀਂ ਜਿਹੜੇ ਕਿੱਦਾਂ ਤੁਹਾਡਾ ਕੀ ਅ ਕੰਮ ਕਾਰ ਚੱਲ ਰਿਹਾ ਅੱਛਾ ਜੀ ਠੀਕ ਹੈ ਕੀ ਕੰਮ ਕਰ ਰਹੇ ਹੋ ਤੁਸੀਂ ਕਿਸ ਪ੍ਰੋਫਾਈਲ ਦੇ ਉੱਤੇ ਹੋ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਓਕੇ ਤੁਸੀਂ ਕੁਛ ਕੁਐਸ਼ਨ ਪੁੱਛਣਾ ਚਾਹੁੰਦੇ ਹੋ ਹਾਂਜੀ ਹਾਂਜੀ ਸਰ ਗੁਰਪ੍ਰੀਤ ਨਾਮ ਹੈ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਟਾਈਮ ਹੈ ਸਰ ਜੀ ਗੱਲ ਕਰ ਸਕਦੇ ਹੋ ਸਰ ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈਗੀ ਹੈ ਜੀ ਉਹ ਗਰੈਜੂਏਸ਼ਨ ਹੈਗੀ ਹੈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਅਤੇ ਜਿਹੜੀ ਪੋਸਟ ਗ੍ਰੈਜੂਏਸ਼ਨ ਹੈਗੀ ਹੈ ਉਹ ਮਾਸਟਰ ਇਨ ਬਿਜਨਸ ਐਡਮੀਨੀਸਟ੍ਰੇਸ਼ਨ ਦੇ ਵਿੱਚ ਹੈ ਜੀ ਠੀਕ ਹੈ ਸਰ ਹਾਂਜੀ ਹਾਂਜੀ ਹਾਂਜੀ ਸਰ ਮੈਂ ਜੀ ਅਸਿਸਟੈਂਟ ਪ੍ਰੋਫੈਸਰ ਦਾ ਪਹਿਲਾਂ ਸਾਢੇ ਤਿੰਨ ਚਾਰ ਸਾਲ ਕੰਮ ਕੀਤਾ ਜੀ ਐਜ਼ ਆ ਲੈਕਚਰਾਰ ਅਤੇ ਬੱਚਿਆਂ ਨੂੰ ਮੈਂ ਪੜ੍ਹਾਇਆ ਹੈ ਮੈਨੇਜਮੈਂਟ ਦੇ ਬੱਚਿਆਂ ਨੂੰ ਬੀਕੋਮ ਦੇ ਬੱਚਿਆਂ ਨੂੰ ਬੀ ਸੀ ਏ ਦੇ ਬੱਚਿਆਂ ਨੂੰ ਮੈਂ ਟੀਚ ਕਰ ਚੁੱਕੀ ਹਾਂ ਅਤੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਬੱਚੇ ਜਿਹੜੇ ਨੇ ਉਹ ਮੈਂ ਸਾਰੇ ਪੜ੍ਹਾ ਚੁੱਕੀ ਹਾਂ ਜੀ ਹੁਣ ਤੱਕ

ਸਰ ਮੈਂ ਫਿਲਹਾਲ ਜੀ ਮੇਰੀ ਹਜੇ ਰੀਸੈਂਟਲੀ ਵੈ ਮੈਰਿਜ ਹੋਈ ਹੈ ਅਤੇ ਹਜੇ ਮੈਂ ਲੁਕਿੰਗ ਫਾਰ ਆ ਜੋਬ ਜੋਬ ਦੇਖ ਰਹੇ ਹਾਂ ਅਸੀਂ ਅਤੇ ਹੁੰ ਹੁੰ ਹੁੰ ਹੁੰ ਸਰ ਕੋਈ ਗੱਲ ਨਹੀਂ ਪ੍ਰੋਜੈਕਟ ਕੋਆ ਹਾਂਜੀ ਹਾਂਜੀ ਸਰ ਪ੍ਰੋਜੈਕਟ ਕੋਆਰਡੀਨੇਟਰ ਦੀ ਵੀ ਕਰ ਲਾਂਗੀ ਕਿਉਂਕਿ ਮੈਂ ਆਪਣੇ ਕੋਲਜ ਦੇ ਕੋਲਜ ਟਾਈਮ ਦੇ ਵਿੱਚ ਬਹੁਤ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਨੇ ਉਹ ਹੈਂਡਲ ਕਰ ਚੁੱਕੀ ਹਾਂ ਜਿਵੇਂ ਕਿ ਬਹੁਤ ਸਾਰੇ ਫੰਕਸ਼ਨਸ ਕਰਵਾਉਣੇ ਅਤੇ ਬਹੁਤ ਸਾਰੇ ਜਿਹੜੇ ਅ ਜਿਵੇਂ ਕਿ ਟੈਕ ਫੈਕਸ ਹੋ ਗਿਆ ਇਹ ਸਾਰੇ ਦੇ ਸਾਰੇ ਅਸੀਂ ਖੁਦ ਹੀ ਕੋਆਡੀਨੇਟ ਕਰਦੇ ਰਹੇ ਹਾਂ ਅਤੇ ਮ ਮਨੀ ਮੈਨੇਜਮੈਂਟ ਵੀ ਅਸੀਂ ਦੇਖੀ ਹੈ ਅਤੇ ਸਰ ਜੀ ਹਜੇ ਛੇ ਕੁ ਮਹੀਨੇ ਹੋਏ ਨੇ ਸਰ ਉਹ ਵੀ ਛੇ ਉਹ ਹੋ ਗਏ ਸੱਤ ਕੁ ਮਹੀਨੇ ਹੋ ਗਏ ਜੀ ਸਰ ਉੱਥੇ ਜੀ ਮਿਲਦੀ ਸੀਗੀ ਪੱਚੀ ਤੋਂ ਤੀਹ ਕੁ ਹਜ਼ਾਰ ਮਿਲਦੀ ਸੀਗੀ ਹਾਂਜੀ ਹਾਂਜੀ ਸਰ ਮੇਰਾ ਫੋਰ ਈਅਰਸ ਦਾ ਥ ਥਰੀ ਮੰਨਥਸ ਇਹ ਹੈ ਥਰੀ ਈਅਰਸ ਏਟ ਮੰਨਥਸ ਦਾ ਐਕਸਪੀਰੀਅਸ ਹੈ ਐਪਰੋਕਸੀਮੇਟਲੀ ਨੀਅਰ ਅਬਾਊਟ ਫੋਰ ਈਅਰਸ ਦਾ ਹੋ ਗਿਆ ਸਰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਅੱਛਾ ਜੀ ਹਾਂਜੀ ਹਾਂਜੀ ਸਰ ਉਹ ਤਾਂ ਐਕਸਪੀਰੀਅੰਸ ਦੇ ਬੇਸਿਸ ਦੇ ਉੱਤੇ ਤੁਸੀਂ ਹਾਂਜੀ ਦੇਖ ਸਕਦੇ ਹੋ ਸਰ ਤੁਸੀਂ ਅ ਦੱਸੋ ਕਦੋਂ ਤੋਂ ਜੋਇਨਿੰਗ ਕਰਵਾ ਸਕਦੇ ਆ ਤਾਂ ਮੈਂ ਜਿੰਨੀ ਜਲਦੀ ਹੋ ਸਕੇ ਓਨਾ ਹੀ ਜਲਦੀ ਜੁਆਇੰਨ ਕਰਨਾ ਚਾਹਾਂਗੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਸਰ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਸਰ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਰ ਅਤੇ ਜਿਵੇਂ ਤੁਸੀਂ ਕਹਿੰਦੇ ਹੋ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਹਾਂਜੀ ਠੀਕ ਹੈ ਸਰ ਓਕੇ ਸਰ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਓਕੇ ਸਰ ਓਕੇ